ਮੈਂ ਘਰ ਵਿੱਚ ਬਹੁਤ ਸਾਰੇ ਪੌਦੇ ਲਗਾਏ ਹੋਏ ਹਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਮੌਜੂਦਾ ਪੌਦਿਆਂ ਤੋਂ ਹੋਰ ਪੌਦੇ ਪੈਦਾ ਕਰਨ ਲਈ ਜਿਹੜੀ ਤਕਨੀਕ ਵਰਤਦਾ ਹਾਂ ਉਹਨਾਂ ਵਿੱਚ ਇੱਕ ਤਾਂ ਇਹ ਹੈ ਕਿ ਕੁਝ ਪੌਦਿਆਂ ਦੀ ਪਿਉਂਦ ਜਾਂ ਕਲਮ ਕੱਟ ਕੇ ਮਿੱਟੀ ਵਿੱਚ ਗੱਡ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਵੀ ਨਵਾਂ ਪੌਦਾ ਤਿਆਰ ਹੋ ਜਾਂਦਾ ਹੈ ਅਤੇ ਕੁਝ ਪੌਦਿਆਂ ਦੀਆਂ ਜੜਾਂ ਹੁੰਦੀਆਂ ਹਨ ਜੋ ਕੱਟ ਕੇ ਲਗਾ ਦਈਏ ਤਾਂ ਵੀ ਨਵਾਂ ਪੌਦਾ ਤਿਆਰ ਹੋ ਜਾਂਦਾ ਹੈ ਅਤੇ ਕੁਝ ਪੌਦਿਆਂ ਦੇ ਫੁੱਲਾਂ ਵਿੱਚ ਬੀਜ ਹੁੰਦੇ ਹਨ ਉਹ ਵੀ ਜਦੋਂ ਅਸੀਂ ਮਿੱਟੀ ਵਿੱਚ ਉਗਾਉਂਦੇ ਹਾਂ ਤਾਂ ਨਵੇਂ ਪੌਦੇ ਉੱਗ ਜਾਂਦੇ ਹਾਂ ਮੇਰੇ ਕੋਲ ਕੁਝ ਪੌਦੇ ਦਵਾਈਆਂ ਦੇ ਹਨ ਉਹਨਾਂ ਨੂੰ ਮੈਂ ਬਿਮਾਰੀ ਨੂੰ ਠੀਕ ਕਰਨ ਲਈ ਵਰਤਦਾ ਹਾਂ ਅਤੇ ਕੁਝ ਪੌਦੇ ਸਜਾਵਟ ਲਈ ਹਨ